ਖੇਡਾਂ ਵਿੱਚ ਮੇਰੀ ਮਨਪਸੰਦ ਕਿਸਮ ਦੀ ਖੇਡ ਕ੍ਰਿਕਟ ਹੈ ਜਿਹਨੂੰ ਕਿ ਮੈਂ ਬਹੁਤ ਹੀ ਚਾਅ ਦੇ ਨਾਲ ਖੇਡਣਾ ਪਸੰਦ ਕਰਦਾ ਹਾਂ ਕਿਉਂਕਿ ਉਹਦੇ ਵਿੱਚ ਮੈਨੂੰ ਕਈ ਖਿਡਾਰੀ ਐਸੇ ਹਨ ਜਿਹੜੇ ਪ੍ਰੇਰਿਤ ਕਰਦੇ ਹਨ ਜਿੱਦਾਂ ਕਿ ਸਚਿਨ ਤੇਂਦੁਲਕਰ ਰਾਹੁਲ ਦ੍ਰਾਵਿੜ ਸੌਰਵ ਗਾਂਗੁਲੀ ਮੈਂ ਛੋਟੇ ਹੁੰਦੇ ਤੋਂ ਦੇਖਦਾ ਆ ਰਿਹਾ ਹਾਂ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਵੀ ਲੱਗਦਾ ਹੈ ਮੈਂ ਵੀ ਉਹਨਾਂ ਵੰਗਰ ਹੀ ਖੇਡਾਂ ਅਤੇ ਕਾਫੀ ਨਾਮ ਕਮਾਵਾਂ ਅਤੇ ਉਸ ਗੇਮ ਦੇ ਵਿੱਚ ਕਾਫੀ ਦਿਮਾਗ ਦੀ ਇਹ ਵਰਤੋਂ ਵੀ ਹੁੰਦੀ ਹੈ ਕਿਉਂਕਿ ਉਹ ਗੇਮ ਕਾਫੀ ਕਾਫੀ ਅੱਛੀ ਹੈ ਉਹ 'ਚ ਇੱਕ ਤਾਂ ਬੰਦਾ ਬੋਲਿੰਗ ਕਰਦਾ ਹੈ ਜਿਹਦੇ ਵਿੱਚ ਦੌੜ ਲਗਾਉਣੀ ਪੈਂਦੀ ਹੈ ਅਤੇ ਸਰੀਰ ਦੀ ਵੀ ਵਰਜਿਸ਼ ਬਹੁਤ ਹੀ ਵਧੀਆ ਤਰੀਕੇ ਨਾਲ ਹੁੰਦੀ ਹੈ ਅਤੇ ਨਾਲੇ ਜਿਹੜੀ ਬੈਟਿੰਗ ਦਾ ਜਿਹੜਾ ਪਰਫੋਰਮਾ ਹੈ ਉਹ 'ਚ ਵੀ ਕਾਫੀ ਮਜ਼ਾ ਆਉਂਦਾ ਹੈ ਜਦੋਂ ਬੰਦਾ ਬੈਟਿੰਗ ਕਰਦਾ ਹੈ ਅਤੇ ਬੋਲਰ ਉਹਨਾਂ ਨੂੰ ਬੋਲ ਪਾਉਂਦਾ ਹੈ ਤਾਂ ਬੈਟਸਮੈਨ ਕਾਫੀ ਅੱਛੀ ਬੈਟਿੰਗ ਕਰਕੇ ਆਪਣਾ ਹੁਨਰਸ ਹੁਨਰ ਦਿਖਾਉਂਦਾ ਹੈ ਹੋਰ ਵੀ ਕਈ ਤਰ੍ਹਾਂ ਦੇ ਕ੍ਰਿਕਟ ਦੇ ਵਿੱਚ ਚੀਜ਼ਾਂ ਹਨ ਜਿਹੜੀਆਂ ਕਿ ਬੰਦਾ ਕਰਕੇ ਮਨੋਰੰਜਨ ਪ੍ਰਾਪਤ ਕਰਦਾ ਹੈ